ਮੈਂ ਜਦ ਵੀ ਕਿਤੇ ਜਾਂਦੀ ਹਾਂ ਆਪਣੇ ਰਿਸ਼ਤੇਦਾਰਾਂ ਨਾਲ ਘਰਦਿਆਂ ਨਾਲ ਜਾਂ ਫਿਰ ਆਪਣੇ ਦੋਸਤਾਂ ਦੇ ਨਾਲ ਮੈਂ ਫੋਟੋਗ੍ਰਾਫੀ ਜ਼ਰੂਰ ਕਰਦੀ ਹਾਂ ਕਿਉਂਕਿ ਜਿਹੜੇ ਉੱਥੇ ਦੀਆਂ ਯਾਦਾਂ ਹੁੰਦੀਆਂ ਨੇ ਉਹ ਫੋਟੋਗ੍ਰਾਫੀ ਰਾਹੀਂ ਆਪਾਂ ਸੰਭਾਲ ਕੇ ਰੱਖ ਸਕਦੇ ਹਾਂ ਕਿਉਂਕਿ ਬਾਅਦ ਵਿੱਚ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਮਿਲਦੀ ਹੈ ਜਦ ਅਸੀਂ ਉਹਨਾਂ ਪੁਰਾਣੀਆਂ ਯਾਦਾਂ ਨੂੰ ਦੇਖਦੇ ਨੇ ਅਤੇ ਜਿਹੜੀ ਫੋਟੋਗ੍ਰਾਫੀ ਹੈ ਉਹ ਬਹੁਤ ਹੀ ਵਧੀਆ ਹੈਗੀ ਹੈ ਅੱਜ ਕੱਲ੍ਹ ਦੇ ਟਾਈਮ ਵਿੱਚ ਅਤੇ ਜਿਹੜਾ ਮੇਰਾ ਅਨੁਭਵ ਹੈਗਾ ਉਹ ਬਹੁਤ ਹੀ ਅੱਛਾ ਹੈਗਾ ਏ ਕਿਉਂਕਿ ਉਹਦੇ ਨਾਲ਼ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਮਿਲਦੀ ਹੈ